ਮੇਰੀ ਮਨ ਪਸੰਦ ਕਿਤਾਬ ਮੈਨੂੰ ਧਾਰਮਿਕ ਕਿਤਾਬਾਂ ਪੜ੍ਹਨੀਆਂ ਜ਼ਿਆਦਾ ਪਸੰਦ ਆ ਅਤੇ ਮੈਂ ਗੁਰੂ ਨਾਨਕ ਦੇਵ ਜੀ ਦੀਆਂ ਸਾਖੀਆਂ ਅਤੇ ਮਤਲਬ ਸਿੱਖ ਧਰਮ ਨਾਲ ਜੋ ਵੀ ਰਿਲੇਟਡ ਹੈ ਹੈ ਨਾ ਉਹਨਾਂ ਨੂੰ ਪੜ੍ਹਨਾ ਅਤੇ ਸੁਣਨਾ ਪਸੰਦ ਕਰਦੀ ਹਾਂ ਨਾ ਅਤੇ ਜਦੋਂ ਮੈਂ ਕੁਛ ਲਿਖਦੀ ਵੀ ਹਾਂ ਤਾਂ ਮੈਨੂੰ ਧਰਮ ਦੇ ਰਿਲੇਟਿਡ ਹੀ ਲਿਖਣ ਨੂੰ ਹੁੰਦਾ ਕਿ ਮੈਂ ਲਿਖਾਂ ਇਹਨਾਂ ਦੇ ਬਾਰੇ ਵੀ ਜਿੱਦਾਂ ਅੱਜ ਕੱਲ੍ਹ ਸਮਾਜ ਵਿੱਚ ਜੋ ਕੁਛ ਵੀ ਹੋ ਰਿਹਾ ਲੋਕਾਂ ਦੇ ਵਿੱਚ ਕਹਿ ਲਓ ਕਿ ਸਬਰ ਹੁਣ ਰਿਹਾ ਨਹੀਂ ਹੈ ਨਾ ਅਤੇ ਮੈਂ ਉਹਨਾਂ ਨੂੰ ਮਤਲਬ ਇਹ ਦੱਸਣ ਦੀ ਕੋਸ਼ਿਸ਼ ਕਰਦੀ ਹਾਂ ਆਪਣੀਆਂ ਲਿਖਾਈਆਂ ਦੇ ਵਿੱਚ ਕਿ ਤੁਸੀਂ ਸਬਰ ਰੱਖੋ ਪਰਮਾਤਮਾ ਤੁਹਾਡੇ ਨਾਲ ਹਰ ਵੇਲੇ ਖੜਾ ਆ ਹੈ ਨਾ ਤੁਹਾਨੂੰ ਚਿੰਤਾ ਕਰਨ ਦੀ ਕੋਈ ਜ਼ਰੂਰਤ ਨਹੀਂ ਹੈਗੀ ਅਤੇ ਆਪਣਾ ਸਾਰੇ ਕੰਮ ਪਰਮਾਤਮਾ ਆਪ ਅੱਗੇ ਹੋ ਕੇ ਕਰਦਾ ਹੈ ਨਾ ਅਤੇ ਜਦੋਂ ਤੁਸੀਂ ਕੰਮ ਨੂੰ ਸ਼ੁਰੂਆਤ ਕਰਦੇ ਹੋ ਇੱਕ ਪ੍ਰਾਰਥਨਾ ਕਰਦੇ ਹੋ ਪ੍ਰਾਰਥਨਾ ਕਰਨ ਤੋਂ ਬਾਅਦ ਅਤੇ ਕੰਮ ਦੀ ਜਦੋਂ ਦੇਖਦੇ ਹੋ ਕਿ ਉਹ ਚੜ੍ਹਦੀ ਕਲਾ ਵਿੱਚ ਆਪਣੇ ਆਪ ਹੀ ਜਾਣ ਲੱਗ ਜਾਂਦਾ ਹੈ ਨਾ ਅਤੇ ਉਦੋਂ ਤੁਹਾਡੇ ਅੰਗ ਸੰਗ ਇੱਕ ਪਰਮਾਤਮਾ ਹੁੰਦਾ ਅਤੇ ਤੁਹਾਨੂੰ ਪਤਾ ਵੀ ਨਹੀਂ ਲੱਗਦਾ ਤੁਹਾਡੇ ਕੰਮ ਆਪਣੇ ਆਪ ਸਾਰੇ ਹੋਣ ਲੱਗ ਜਾਂਦੇ ਹੈ ਅਤੇ ਇਸ ਤ ਉਹਨਾਂ ਨੂੰ ਮਤਲਬ ਮੈਂ ਜ਼ਿਆਦਾ ਪੰਜਾਬੀ ਭਾਸ਼ਾ ਵਿੱਚ ਲਿਖਣਾ ਪਸੰਦ ਕਰਦੀ ਹਾਂ ਅਤੇ ਪੰਜਾਬੀ ਭਾਸ਼ਾ ਮੈਨੂੰ ਮਤਲਬ ਅੱਛੀ ਲੱਗਦੀ ਜਿਹੜੀ ਆਮ ਹਰ ਇੱਕ ਦੀ ਸਮਝ ਦੇ ਵਿੱਚ ਵੀ ਆਰਾਮ ਨਾਲ ਆ ਜਾਂਦੀ ਹੈ ਇਸ ਕਰਕੇ ਮਤਲਬ ਮੈਨੂੰ ਪੰਜਾਬੀ ਪਸੰਦ ਹੈ